ਮੈਂ ਰਾਮਦਾਸ ਪਿੰਡ ਨਵਾਂ ਗਰਾਂ ਡਾਕ ਖਾਨਾ ਸੁਜਾਨਪੁਰ ਤਹਿਸੀਲ ਅਤੇ ਜਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਅਤੇ ਗੱਲ ਚੱਲੀ ਹੈ ਕਿ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਿਲ ਹੋਣ ਵਾਸਤੇ ਬਹੁਤ ਮਦਦ ਕੀਤੀ ਹੈ ਤੁਸੀਂ ਯੂਟੀਊਬ 'ਤੇ ਜਾਂ ਗੂਗਲ ਕਰੋਮ 'ਤੇ ਬਹੁਤ ਸਾਰੇ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਅਤੇ ਇਹਦੇ ਵਿੱਚ ਤੁਹਾਨੂੰ ਲੋਕਾਂ ਦੀ ਕਲਾ ਦਾ ਪਤਾ ਚੱਲਦਾ ਹੈ ਲੋਕਾਂ ਦੀ ਸ਼ਿਲਪਕਾਰੀ ਦਾ ਪਤਾ ਚੱਲਦਾ ਹੈ ਅਤੇ ਉਹਨਾਂ ਨੂੰ ਦੇਖ ਦੇਖ ਕੇ ਜਾਂ ਸੁਣ ਸੁਣ ਕੇ ਤੁਸੀਂ ਵੀ ਕਲਾ ਵਿੱਚ ਨਿਪੁੰਨ ਹੋ ਸਕਦੇ ਹਾਂ ਅਤੇ ਇਹ ਕਹਿਣ ਦਾ ਭਾਵ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਲੋਕਾਂ ਦੀ ਕਲਾ ਅਤੇ ਸ਼ਿਲਪਕਾਰੀ ਨਿਖਾਰਨ ਵਿੱਚ ਬੜਾ ਯੋਗਦਾਨ ਪਾਇਆ ਹੈ ਹਾਂ ਮੈਂ ਤੁਸੀਂ ਪੁੱਛਿਆ ਕਿ ਕੀ ਇੱਥੇ ਕੋਈ ਆਰਟ ਅਤੇ ਕਰਾਫਟ ਯੂਟਿਊਬ ਚੈਨਲ ਹਨ ਜਿਨ੍ਹਾਂ ਦਾ ਤੁਸੀਂ ਅਨੁਸਰਨ ਕਰ ਕਰਦੇ ਹੋ ਹਾਂ ਮੈਂ ਕਰਦਾ ਹਨ ਅਨੁਸਰਨ ਯੂਟੀਊਬ ਚੈਨਲ ਇਸ ਇਹਨਾਂ ਚੀਜ਼ਾਂ ਨਾਲ ਭਰਿਆ ਪਿਆ ਹੈ ਯੂਟਿਊਬ ਇੱਕ ਇਹੋ ਜਿਹਾ ਚੈਨਲ ਹੈ ਜਿਸ ਵਿੱਚ ਹਰ ਪ੍ਰਕਾਰ ਦੀ ਇੱਕ ਚੀਜ਼ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੁਣਨ ਨੂੰ ਮਿਲਦੀ ਹੈ ਇਸ ਵਿੱਚ ਮਹਾਨ ਮਹਾਨ ਜਿਹੜੇ ਹੈ ਚਿੱਤਰਕਾਰ ਜਾਂ ਪੇਂਟਰ ਉਹਨਾਂ ਦੀ ਕ੍ਰਿਤੀਆਂ ਵੀ ਦੇਖਣ ਨੂੰ ਮਿਲਦੀਆਂ ਹਨ ਫਿਰ ਗਾਉਣ ਵਾਲੇ ਕਲਾਕਾਰ ਭਾਵੇਂ ਉਹ ਪਹਿਲੀ ਸਟੇਜ 'ਤੇ ਹੋਣ ਉਹ ਉਹਨਾਂ ਨੂੰ ਵੀ ਦੇਖਣ ਦਾ ਸੁਣਨ ਦਾ ਮੌਕਾ ਮਿਲਦਾ ਹੈ ਅਤੇ ਯੂਟੀਊਬ ਇੱਕ ਬਹੁਤ ਵਧੀਆ ਚੈਨਲ ਹੈ ਜਿਹਨੂੰ ਆਮ ਲੋਕ ਵੀ ਜਿਹੜੇ ਆ ਦੇਖ ਕੇ ਜੇ ਉਹ ਕਲਾ ਰੱਖਦੇ ਨੇ ਅਤੇ ਇਹ ਉਹ ਜ਼ਰੂਰ ਜਿਹੜਾ ਹੈ ਉਹਨਾਂ ਦੀ ਮਦਦ ਕਰਦਾ ਹੈ